ਕਿਸਾਨਾਂ ਦੀ ਖੁਦਕੁਸ਼ੀ ਦਾ ਕਾਰਨ ਵਾਧੂ ਖਰਚਾ ਹੈ ਜੋ ਆਪਾਂ ਇੱਕ ਦੂਸਰੇ ਨੂੰ ਦੇਖ ਕੇ ਇੱਕ ਦੂਜੇ ਦੀ ਰੀਸ ਕਰਕੇ ਆਪਣੀ ਆਮਦਨ ਤੋਂ ਵੱਧ ਖਰਚਾ ਕਰਦੇ ਹਨ ਜੇ ਕਿਸੇ ਨੇ ਅੱਜ ਕੋਈ ਛੋਟੀ ਮਸ਼ੀਨਰੀ ਲਈ ਤਾਂ ਉਹਨੂੰ ਦੇਖ ਕੇ ਦੂਸਰੇ ਦਿਨ ਦੂਜਾ ਕੋਈ ਵੱਡੀ ਮਸ਼ੀਨਰੀ ਲਿਆਉਂਦਾ ਚਾਹੇ ਉਹ ਬੈਂਕ ਦਾ ਕਰਜਾ ਚੁੱਕ ਕੇ ਹੀ ਲੈਂਦਾ ਇਹ ਉਸ ਤੋਂ ਹੀ ਸਭ ਤੋਂ ਵੱਡੀ ਖੁਦਕੁਸ਼ੀ ਦਾ ਘਰ ਹੈ ਦੂਜਾ ਇਹ ਗੱਲ ਹੈ ਕਿ ਆਪਾਂ ਇਹਨੂੰ ਆਪਣੀ ਵਿਆਹ ਸ਼ਾਦੀਆਂ ਸਿੰਪਲ ਤੌਰ 'ਤੇ ਹੀ ਕਰਨੇ ਚਾਹੀ ਜੇ ਕਿਸੇ ਦੇ ਮਰਕਤ ਦਾ ਭੋਗ ਹੈ ਉਹਦੇ ਉੱਤੇ ਵੀ ਕੋਈ ਜਿਆਦਾ ਨਹੀਂ ਆਪਣੀ ਲਿਮਿਟ ਦੇ ਮੁਤਾਬਿਕ ਸਾਦਾ ਭੋਗ ਪਾਓ ਅਤੇ ਵਿਆਹ ਸ਼ਾਦੀਆਂ 'ਤੇ ਵੀ ਵੱਧ ਘੱਟ ਤੋਂ ਘੱਟ ਖਰਚਾ ਕਰੋ ਸਾਦੇ ਵਿਆਹ ਰੱਖੋ ਜੇ ਸਰਕਾਰ ਇਹਨਾਂ ਚੀਜ਼ਾਂ 'ਤੇ ਰੋਕਥਾਮ ਲਾਏਗੀ ਅਤੇ ਕਿਸਾਨਾਂ ਦੀ ਖੁਦਕੁਸ਼ੀ ਆਪੇ ਹੀ ਘਟ ਜਾਵੇਗੀ ਅਤੇ ਉਹ ਕਰਜਈ ਨਹੀਂ ਹੋਵੇਗਾ